ਪੰਜਾਬ ਦਾ ਆਵਾਜਾਈ ਬੁਨਿਆਦੀ ਢਾਂਚਾ ਭਾਰਤ ਦੇ ਹੋਰ ਹਿੱਸਿਆਂ ਨਾਲ ਕਾਫੀ ਵਧੀਆ ਤਰੀਕੇ ਨਾਲ ਤੁਲਨਾ ਕਰਦਾ ਹੈ ਜਿਵੇਂ ਪੰਜਾਬ 'ਚ ਸ ਕਾਫੀ ਦੇਖਿਆ ਜਾਵੇ ਕਿ ਕਾਫੀ ਦੇਸ਼ ਭਗਤ ਵੀ ਜਿਹੜੇ ਹੋਏ ਨੇ ਪੰਜਾਬ ਤੋਂ ਹੀ ਹੋਏ ਨੇ ਜਿਵੇਂ ਕਿ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜੀ ਹੋਰ ਵੀ ਇਸ ਤਰ੍ਹਾਂ ਹੀ ਦੇਸ਼ ਭਗਤ ਜੋ ਦੇਸ਼ ਲਈ ਲੜੇ ਨੇ ਦੇਸ਼ ਦੀ ਆਜ਼ਾਦੀ ਲਈ ਲੜੇ ਨੇ ਉਹ ਵੀ ਪੰਜਾਬ ਤੋਂ ਹੀ ਨਿਕਲੇ ਨੇ ਪੰਜਾਬ ਦੀ ਇੱਕ ਹੋਰ ਖ਼ਾਸੀਅਤ ਹੈ ਕਿ ਇੱਥੇ ਇਹਨੂੰ ਗੁਰੂਆਂ ਪੀਰਾਂ ਦੀ ਧਰਤੀ ਮੰਨਿਆ ਜਾਂਦਾ ਹੈ ਠੀਕ ਹੈ ਇੱਥੇ ਕਾਫੀ ਸਾਰੇ ਗੁਰੂ ਸਾਹਿਬਾਨ ਜੰਮੇ ਨੇ ਠੀਕ ਹੈ ਜਿਹਦੇ ਕਰਕੇ ਇੱਥੇ ਗੁਰਦੁਆਰਾ ਫੇਮਸ ਹੈ ਪੰਜਾਬ 'ਚ ਗੁਰਦੁਆਰੇ ਵਿੱਚ ਸਾਨੂੰ ਲੰਗਰ ਦੀ ਫੈਸਿਲਿਟੀ ਹੈ ਠੀਕ ਹੈ ਰਹਿਣ ਸਹਿਣ ਦੀ ਫੈਸਿਲਟੀ ਹੈ ਜੋ ਕਿ ਇਹ ਅਨਿਆ ਰਾਜਾਂ ਵਿੱਚ ਨਹੀਂ ਆ ਜੇਕਰ ਆਪਾਂ ਕਿਤੇ ਹੋਰ ਜਾ ਕੇ ਰਹਿ ਰਹੇ ਹੈ ਤੁਹਾਨੂੰ ਖਾਣ ਦੇ ਵੀ ਪੈਸੇ ਦੇਣੇ ਪੈ ਰਹੇ ਅਤੇ ਰਹਿਣ ਦੇ ਵੀ ਬਟ ਜੇਕਰ ਆਪਾਂ ਪੰਜਾਬ 'ਚ ਕਿਸੇ ਗੁਰਦੁਆਰੇ ਵਿੱਚ ਰਹਿ ਰਹੇ ਹਾਂ ਤੁਹਾਨੂੰ ਸਾਨੂੰ ਬਿਨਾਂ ਕੋਈ ਪੈਸੇ ਪੇਅ ਕੀਤੇ ਖਾਣ ਨੂੰ ਵੀ ਮਿਲ ਰਿਹਾ ਰਹਿਣ ਨੂੰ ਵੀ ਮਿਲ ਰਿਹਾ ਅਤੇ ਜੇਕਰ ਕੋਈ ਇੱਥੇ ਘੁੰਮਣਾ ਚਾਹੁੰਦਾ ਜਿਵੇਂ ਕੋਈ ਆਪਣਾ ਸੈਲਾਨੀ ਕੋਈ ਘੁੰਮਣ ਆਇਆ ਵਾ ਅਤੇ ਕਿਵੇਂ ਘੁੰਮ ਸਕਦਾ ਕੋਈ ਮੈਟਰੋ ਕਰ ਸਕਦਾ ਕਾਰ ਕਰ ਸਕਦਾ ਔਟੋਜ਼ ਚੱਲਦੇ ਨੇ ਇੱਥੇ ਸੋ ਕਿਰਾਏ 'ਤੇ ਬਾਈਕਸ ਮਿਲਦੀਆਂ ਨੇ ਠੀਕ ਆ ਨਾ ਉਹ ਆਪਣਾ ਬੁੱਕ ਕਰਨ ਅਤੇ ਆਰਾਮ ਨਾਲ ਘੁੰਮਣ ਨਿਕਲ ਜਾਣ ਪੰਜਾਬ 'ਚ ਇੱਕ ਵਧੀਆ ਪਲੇਸ ਜਿਹੜੀ ਘੁੰਮਣ ਨੂੰ ਮਤਲਬ ਜਿਹੜਾ ਟੂਰਿਸਟ ਰਿਪੋਰਟ ਜਿਹਨੂੰ ਮੰਨਿਆ ਚੰਡੀਗੜ੍ਹ ਉੱਥੇ ਕਾਫੀ ਕੁਛ ਘੁੰਮਣ ਲਾਇਕ ਆ ਕੁਝ ਧਾਰਮਿਕ ਸਥਾਨ ਨਵੇਂ ਗੁਰਦੁਆਰਾ ਵੀ ਆ ਗਾਰਡਨਸ ਵੀ ਆ ਠੀਕ ਆ ਪਲੇਅਗਰਾਊਂਡਸ ਵੀ ਆ ਮੋਲ ਵੀ ਹੈਗੇ ਨੇ ਪੰਜਾਬ 'ਚ ਅਤੇ ਕਾਫੀ ਕੁਝ ਹੈਗਾ ਪੰਜਾਬ 'ਚ ਘੁੰਮਣ ਨੂੰ